ਹਾਂਜੀ ਨਮਸਕਾਰ ਸਰ ਸਰ ਅਸੀਂ ਇੱਕ ਅਖ਼ਬਾਰ ਵਿੱਚ ਆਪਣਾ ਆਰਟੀਕਲ ਪੇਸ਼ ਕਰਨਾ ਹੈ ਉਸ ਵਿੱਚ ਅਸੀਂ ਅੰਧ ਵਿਸਵਾਸ਼ਾਂ ਬਾਰੇ ਲਿਖਣਾ ਹੈ ਤੁਸੀਂ ਸਾਨੂੰ ਦੱਸੋਗੇ ਕਿ ਤੁਹਾਡੇ ਆਸ ਪਾਸ ਕਿਹੜੇ ਕਿਹੜੇ ਇੰਧ ਅੰਧ ਵਿਸ਼ਵਾਸ਼ ਪਾਏ ਜਾਂਦੇ ਹਨ ਸਰ ਤੁਸੀਂ ਇਹਨਾਂ ਅੰਧ ਵਿਸ਼ਵਾਸ਼ਾਂ 'ਤੇ ਵਿਸ਼ਵਾਸ਼ ਰੱਖਦੇ ਹੋ ਠੀਕ ਹੈ ਸਰ ਸਰ ਤੁਹਾਡਾ ਸਾਡੇ ਨਾਲ ਗੱਲ ਬਾਤ ਕਰਨ ਲਈ ਧੰਨਵਾਦ